ਹੈਲੋ ਮੈਂ ਫਿਰੋਜ਼ਪੁਰ ਦੇ ਉਧਮ ਸਿੰਘ ਚੌਂਕ ਦੇ ਚੁਰਾਹੇ ਤੋਂ ਬੋਲ ਰਿਹਾਂ ਇੱਥੇ ਇੱਕ ਆਦਮੀ ਬਹੁਤ ਬੁਰੀ ਜ਼ਖਮੀ ਹਾਲਾਤ ਵਿੱਚ ਪਿਆ ਹੋਇਆ ਹੈ ਜਿਸ ਦੇ ਹੱਥ ਪੈਰ ਦੇ ਸੱਟਾਂ ਲੱਗੀਆਂ ਹੋਈਆਂ ਹਨ ਉਸ ਦਾ ਸਾਹ ਵੀ ਨਹੀਂ ਚੱਲ ਰਿਹਾ ਜਲਦ ਤੋਂ ਜਲਦ ਇੱਥੇ ਐਮਰਜੰਸੀ ਲਈ ਐਬੂਲੈਂਸ ਭੇਜੀ ਜਾਵੇ ਇਸ ਦਾ ਸਾਹ ਵੀ ਨਹੀਂ ਚੱਲ ਰਿਹਾ ਨਬਜ਼ ਫੜੀ ਨਹੀਂ ਜਾ ਰਹੀ ਬਲੱਡ ਬਹੁਤ ਜ਼ਿਆਦਾ ਵਹਿ ਰਿਹਾ ਇਸ ਕਰਕੇ ਫੁੱਲੀ ਆਟੋਮੈਟਡ ਜੋ ਐਬੂਲੈਂਸ ਆ ਉਹ ਭੇਜੀ ਜਾਵੇ ਤਾਂ ਜੋ ਇਸਦੀ ਜਾਨ ਬਚਾਈ ਜਾਵੇ ਇਹ ਜੋ ਜਗ੍ਹਾ ਹੈ ਇਹ ਊਧਮ ਸਿੰਘ ਚੌਂਕ ਦੇ ਬਿਲਕੁਲ ਨੁੱਕਰ 'ਤੇ ਹੈ ਇਹਦੀ ਪ ਆਦਮੀ ਦੇ ਸਿਰ ਵਿੱਚੋਂ ਵੀ ਖੂਨ ਨਿਕਲ ਰਿਹਾ ਹੈ ਅਤੇ ਉਸਦੇ ਹੱਥ ਪੈਰ ਦੀ ਬਹੁਤ ਬੁਰੀ ਹਾਲਤ ਹੈ ਇਸ ਲਈ ਜ਼ਰੂਰੀ ਹੈ ਕਿ ਜਲਦ ਤੋਂ ਜਲਦ ਇਥੇ ਪੁੱਜਿਆ ਜਾਵੇ ਤਾਂ ਜੋ ਉਸਦੀ ਆਦਮੀ ਦੀ ਜਾਨ ਬਚਾਈ ਜਾ ਸਕੇ